ਸ਼ੇਅਰ ਮਾਰਕੀਟ ਵਿੱਚ ਪੈਸੇ ਲਗਾਉਣਾ ਤਾਂ ਅੱਜ ਕੱਲ੍ਹ ਇੱਕ ਫੈਸ਼ਨ ਹੀ ਬਣ ਚੁੱਕਿਆ ਹੈ ਜਿਵੇਂ ਕਿ ਆਪਾਂ ਨੂੰ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਜਿਵੇਂ ਕਿ ਫਾਇਦਾ ਅਤੇ ਨੁਕਸਾਨ ਉਵੇਂ ਸ਼ੇਅਰ ਮਾਰਕੀਟ ਦੇ ਵੀ ਫਾਇਦਾ ਅਤੇ ਨੁਕਸਾਨ ਦੋਵੇਂ ਹੀ ਹੈ ਜੇਕਰ ਸਾਨੂੰ ਫਾਇਦਾ ਹੁੰਦਾ ਤਾਂ ਸਾਡੇ ਪੈਸੇ ਵੱਧਦੇ ਹਨ ਅਤੇ ਜੇਕਰ ਸਾਨੂੰ ਨੁਕਸਾਨ ਹੁੰਦਾ ਤਾਂ ਸਾਡੇ ਪੈਸੇ ਘੱਟਦੇ ਹਨ ਸ਼ੇਅਰ ਮਾਰਕੀਟ ਵਿੱਚ ਅਸੀਂ ਬਹੁਤ ਸਾਰੀ ਕੰਪਨੀਆਂ ਵਿੱਚ ਆਪਦੇ ਪੈਸੇ ਲਗਾ ਦਿੰਦੇ ਹਾਂ ਜਿਸ ਕਰਕੇ ਜੇਕਰ ਕੰਪਨੀ ਦੇ ਸ਼ੇਅਰ ਵਧਦੇ ਜਾਂਦੇ ਤਾਂ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਫਾਇਦਾ ਹੋਣ ਨਾਲ ਸਾਡੀ ਆਰਥਿਕ ਸਥਿਤੀ ਵੀ ਸੁਧਰਦੀ ਹੈ ਅਤੇ ਸਾਡੇ ਪੈਸੇ ਵੱਧਦੇ ਆ ਜੇਕਰ ਸਾਡੇ ਪੈਸੇ ਨ ਜੇਕਰ ਸਾਡੇ ਸ਼ੇਅਰ ਨਹੀਂ ਸਹੀ ਹੁੰਦੇ ਤਾਂ ਸਾਨੂੰ ਨੁਕਸਾਨ ਹੁੰਦਾ ਸਾਨੂੰ ਨੁਕਸਾਨ ਹੋਏਗਾ ਅਤੇ ਸਾਡੀ ਆਰਥਿਕ ਸਥਿਤੀ ਵੀ ਖਰਾਬ ਹੁੰਦੀ ਹੈ ਸਾਡੇ ਸ਼ ਜਿਹੜੇ ਸ਼ੇਅਰ ਆ ਬਹੁਤ ਸਾਰੇ ਕੰਪਨੀਆਂ ਵਿੱਚ ਵੰਡੇ ਜਾਂਦੇ ਹਨ ਜਿਸ ਕਰਕੇ ਜੇਕਰ ਕਿਸੇ ਕੰਪਨੀ ਦੀ ਸ਼ੇਅਰ ਘੱਟਦੇ ਹਨ ਜਾਂ ਸ਼ੇਅਰ ਡਿੱਗਦੇ ਹਨ ਤਾਂ ਉਸ ਕੰਪਨੀ ਨੂੰ ਹੀ ਨੁਕਸ ਉਸ ਕੰਪਨੀ ਦੀ ਸ਼ੇਅਰ ਹੀ ਨੁਕਸਾਨ ਹੁੰਦੇ ਹਨ ਪਰ ਜੇਕਰ ਸਾਡੇ ਸਾਹ ਬਾਕੀ ਸ਼ੇਅਰ ਸਾਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਬਾਕੀ ਸ਼ੇਅਰ ਸਾਨੂੰ ਵਧੀਆ ਫਾਇਦਾ ਹੀ ਦਿੰਦੇ ਹਨ ਇਹ ਸ਼ੇਅਰਸ ਖਰੀਦਣ ਨਾਲ ਸਾਡੀ ਆਰਥਿਕ ਸਥਿਤੀ ਵਧੀਆ ਬਣ ਜਾਂਦੀ ਜਿਵੇਂ ਬਿਟਕੋਇਨ ਹੋ ਗਿਆ ਨਿਫਟੀ ਇਹ ਸਭ ਸ਼ੇਅਰ ਮਾਰਕੀਟ ਦੀ ਇਗਜ਼ਾ ਇੱਕ ਉਦਾਹਰਨਾਂ ਹਨ ਇਸ ਨਾਲ ਸਾਨੂੰ ਫਾਇਦਾ ਅਤੇ ਨੁਕਸਾਨ ਦੋਵੇਂ ਹੀ ਹੈ ਅਤੇ ਸਾਨੂੰ ਬੜੀ ਸੋਚ ਸਮਝ ਅਤੇ ਜ਼ਿੰਮੇਵਾਰੀ ਨਾਲ ਇਹਨਾਂ ਸ਼ੇਅਰ ਨੂੰ ਆਪਣੇ ਲਗਾਉਣਾ ਚਾਹੀਦਾ ਹੈ ਅਤੇ ਤਾਂ ਕਿ ਨਾ ਸਾਨੂੰ ਨੁਕਸਾਨ ਸਹਿਣਾ ਪਵੇ ਅਤੇ ਸਾਨੂੰ ਫਾਇਦਾ ਹੀ ਫਾਇਦਾ ਹੋਵੇ